ਹੈਲੋ ਵੀਰੇ ਤੁਸੀਂ ਬਰਾੜ ਬਰਾੜ ਕੈਬ ਬੁੱਕ ਤੋਂ ਬੋਲ ਰਹੇ ਹੋ ਸਰ ਮੈਂ ਤੁਹਾਨੂੰ ਦੋ ਘੰਟੇ ਪਹਿਲਾਂ ਇੱਕ ਕੈਬ ਬੁੱਕ ਕੀਤੀ ਸੀ ਜਿਹਦੇ ਵਿੱਚ ਤੁਹਾਨੂੰ ਕਿਹਾ ਸੀ ਕਿ ਮੈਨੂੰ ਦੋ ਘੰਟੇ ਵਾਸਤੇ ਚਾਹੀਦੀ ਹੈ ਸਰ ਮੈਨੂੰ ਉਹ ਦੋ ਘੰਟੇ ਵਾਲੀ ਜਿਹੜੀ ਬੈ ਕੈਬ ਬੁੱਕ ਕੀਤੀ ਸੀ ਉਹ ਹਜੇ ਤੱਕ ਨਹੀਂ ਪਹੁੰਚੀ ਹੈ ਸਰ ਮੈਂ ਇੱਥੇ ਜਿੱਥੇ ਖੜ੍ਹੀ ਹਾਂ ਇੱਥੇ ਬਹੁਤ ਹੀ ਗਰਮੀ ਹੈ ਅਤੇ ਨਾਲ ਸੁੰਨ ਸਰਾਂ ਵੀ ਹੈ ਅਤੇ ਸਰ ਇੱਥੇ ਖੜ੍ਹਨਾ ਬਹੁਤ ਔਖਾ ਹੈ ਇਸ ਕਰਕੇ ਸਰ ਮੈਂ ਥੋੜ੍ਹੀ ਬੀਮਾਰ ਵੀ ਹਾਂ ਜਿਸ ਕਰਕੇ ਮੈਂ ਹੋਸਪੀਟਲ ਵੀ ਜਾਣਾ ਸੀਗਾ ਅਤੇ ਦਵਾਈ ਵੀ ਲੈਣੀ ਸੀਗੀ ਜਿਸ ਕਰਕੇ ਜਿਹੜੀ ਤੁਸੀਂ ਤੁਹਾਡੀ ਕੈਬ ਹੈ ਕਿ ਹਜੇ ਦੋ ਘੰਟਿਆਂ ਤੋਂ ਉੱਪਰ ਟਾਈਮ ਹੋ ਗਿਆ ਹੈ ਜਿਹੜੀ ਕਿ ਹਜੇ ਤੱਕ ਨਹੀਂ ਪਹੁੰਚੀ ਹੈ ਅਤੇ ਸਰ ਪਲੀਜ਼ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕਿੰਨੇ ਵਜੇ ਤੱਕ ਤੁਹਾਡੀ ਕੈਬ ਮੇਰੇ ਕੋਲ ਪਹੁੰਚ ਸਕਦੀ ਹੈ ਸਰ ਮੈਂ ਚੰਡੀਗੜ੍ਹ ਤੋਂ ਬਠਿੰਡੇ ਜਾਣਾ ਹੈ ਜਿਸ ਮੇਰਾ ਬਹੁਤ ਹੀ ਜ਼ਰੂਰੀ ਕੰਮ ਹੈ ਮੇਰਾ ਜਾਣਾ ਬਹੁਤ ਹੀ ਜ਼ਰੂਰੀ ਹੈ ਸਰ ਮੈਂ ਤੁਹਾਨੂੰ ਛੇਤੀ ਕੈਬ ਭੇਜਣ ਲਈ ਕਿਹਾ ਸੀ ਤੁਸੀਂ ਮੈਨੂੰ ਦੋ ਘੰਟੇ ਤੋਂ ਪਹਿਲਾਂ ਮੈਂ ਤੁਹਾਨੂੰ ਬੁੱਕ ਕੀਤੀ ਸੀ ਤੁਸੀਂ ਕਿਹਾ ਸੀ ਕਿ ਤੁਹਾਡੇ ਕੋਲ ਪੰਦਰਾਂ ਮਿੰਟਾਂ ਵਿੱਚ ਪਹੁੰਚ ਜਾਵੇਗੀ ਬਟ ਹਜੇ ਤੱਕ ਕੈਬ ਨਹੀਂ ਪਹੁੰਚੀ ਹੈ ਜਿਸ ਕਰਕੇ ਮੇਰਾ ਕੰਮ ਰੁਕ ਰਿਹਾ ਹੈ ਪਲੀਜ਼ ਸਰ ਛੇਤੀ ਤੋਂ ਛੇਤੀ ਮੈਨੂੰ ਕੈਬ ਭੇਜੀ ਜਾਵੇ ਜਿਸ ਕਰਕੇ ਮੈਂ ਆਪਣੇ ਜ਼ਰੂਰੀ ਸਥਾਨ ਸੇ ਪਹੁੰਚ ਸਕਾਂ ਅਤੇ ਇੱਥੇ ਗਰਮੀ ਤੋਂ ਵੀ ਬਚ ਸਕਾਂ ਅਤੇ ਆਪਣੀ ਮੈਡੀਸਿਨ ਵੀ ਲੈ ਸਕਾ ਪਲੀਜ਼ ਸਰ ਮੈਨੂੰ ਛੇਤੀ ਤੋਂ ਛੇਤੀ ਦੱਸਿਆ ਜਾਵੇ ਕਿ ਮੇਰੀ ਕੈਬ ਕਿੰਨੇ ਵਜੇ ਤੱਕ ਪਹੁੰਚ ਸਕਦੀ ਹੈ ਤਾਂ ਕਿ ਮੈਂ ਆਪਣੇ ਜ਼ਰੂਰੀ ਕੰਮ ਨਿਪਟਾ ਸਕਾਂ ਅਤੇ ਉੱਥੇ ਪਹੁੰਚ ਸਕਾਂ ਪਲੀਜ਼ ਸਰ ਤੁਹਾਡੀ ਬਹੁਤ ਵੱਡਾ ਧੰਨਵਾਦੀ ਹੋਵਾਂਗੀ ਅਗਰ ਤੁਸੀਂ ਮੈਨੂੰ ਛੇਤੀ ਤੋਂ ਛੇਤੀ ਦੱਸ ਸਕਦੇ ਹੋ ਤਾਂ